ਮੈਂ ਇੱਕ ਅਜਿਹਾ ਵਿਸ਼ੇ ਹੈ ਜਿਹਦੇ ਮੇ ਮੈਂ ਲਿਖਣਾ ਚਾਹੁੰਦਾ ਹਨ ਬਟ ਮੈਂ ਲਿਖਣਾ ਸੰਕੋਚ ਕਰਦਾ ਇਹ ਐਕਚੁਲੀ ਇੱਕ ਮੂਵੀ ਮੇਰੇ ਦਿਮਾਗ 'ਚ ਹੈ ਕਿ ਮੈਂ ਵੱਡਾ ਹੋ ਕੇ ਮੂਵੀ ਡਾਇਰੈਕਟ ਕਰਾਂ ਅਤੇ ਮੈਂ ਮੂਵੀ ਬਾਰੇ ਲਿਖ ਹੈ ਕਾਫੀ ਮੂਵੀ ਬਾਰੇ ਮੈਂ ਲਿਖਿਆ ਹੈ ਮੈਂ ਸੋਚਿਆ ਹੈ ਬਟ ਮੈਂ ਕਦੇ ਇਹਦੇ ਬਾਰੇ ਖੁੱਲ੍ਹ ਕੇ ਲਿਖਿਆ ਨਹੀਂ ਹੈ ਪਰ ਮੈਂ ਇਹਦੇ ਬਾਰੇ ਲਿਖਣਾ ਚਾਹੁੰਦਾ ਹਾਂ ਇਹ ਮੂਵੀ ਇੱਕ ਸੁਪਰ ਹੀਰੋ ਮੂਵੀ ਹੈ ਇੱਕ ਮਤਲਬ ਇੱਕ ਬੰਦਾ ਰੂਕੈਨਡੋ ਨਾਮ ਦਾ ਉਹਦੇ ਉੱਤੇ ਮੈਂ ਇੱਕ ਮੂਵੀ ਤਿਆਰ ਕੀਤੀ ਹੈ ਦਿਮਾਗ ਵਿੱਚ ਅਤੇ ਮੈਂ ਉਹਨੂੰ ਸਕ੍ਰਿਪਟ ਰਾਈਟ ਕਰਕੇ ਆਪਣੀ ਕਾਪੀ ਵਿੱਚ ਲਿਖਣਾ ਚਾਹੁੰਦਾ ਪੇਜ ਲਿਖਣਾ ਚਾਹੁੰਦਾ ਤਾਂ ਕਿ ਮੈਂ ਉਹਨੂੰ ਕਦੇ ਨਾ ਕਦੇ ਕਿਸੇ ਨੂੰ ਪਰਸੈਂਟ ਕਰਕੇ ਤਾਂ ਉਹਨੂੰ ਇੰਪਰੈਸ ਕਰ ਸਕਾਂ ਅਤੇ ਮੈਂ ਸ਼ਾਇਦ ਵੱਡੇ ਹੋ ਕੇ ਆਪਣੀ ਇਹ ਮੂਵੀ ਡਾਇਰੈਕਟ ਕਰ ਸਕਾਂ ਇਹ ਜਿਹਾ ਵਿਸ਼ੇ ਮੈਂ ਸਿਰਫ ਸੋਚਿਆ ਕਦੇ ਲਿਖੇ ਕਦੇ ਲਿਖਿਆ ਨਹੀਂ ਪਰ ਜੇ ਮੈਂ ਲਿਖਿਆ ਤਾਂ ਫਿਰ ਇਹ ਬਹੁਤ ਵੱਡਾ ਹੋ ਜਾਣਾ ਅਤੇ ਮੈਂ ਸ਼ਾਇਦ ਇਹਨੂੰ ਕਦੇ ਸੰਭਾਲ ਨਾ ਪਾਵਾਂ ਅਤੇ ਜਦੋਂ ਮੈਂ ਵੱਡਾ ਹੋਵੇਗਾ ਉਦੋਂ ਲਿਖੂਗਾ ਤਾਂ ਕਿ ਮੈਂ ਉਹ ਇਹਨੂੰ ਸੰਭਾਲ ਕੇ ਰੱਖ ਸਕਾਂ